ਹਾਂਜੀ ਦਵਿੰਦਰ ਸਿੰਘ ਜੀ ਕੀ ਹਾਲ ਚਾਲ ਨੇ ਜੀ ਸਤਿ ਅ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆਪਣੇ ਸ਼ਹੀਦੀ ਜੋੜ ਮੇਲਾ ਕਦੋਂ ਸ਼ੁਰੂ ਹੋਣਾ ਜੀ ਅੱਛਾ ਜੀ ਹਾਂਜੀ

ਹਾਂਜੀ ਹਾਂਜੀ ਅਸੀਂ ਆਉਣਾ ਸੀ ਜੀ ਅ ਜੀ ਜੀ ਹਾਂਜੀ ਕਿਵੇਂ ਹੈ ਮਾਹੌਲ ਇੱਧਰ ਦਾ ਕਿਵੇਂ ਹੈ ਜੀ ਸਿੱਖ ਇਤਿਹਾਸ ਹਾਂਜੀ

ਜੀ ਸਰ

ਹਾਂਜੀ

ਅੱਛਾ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਹਾਂਜੀ ਅੱਛਾ ਜੀ

ਠੀਕ ਹੈ ਜੀ ਠੀਕ ਹੈ ਜੀ ਹਮ ਠੀਕ ਹੈ ਜੀ ਹਾਂਜੀ

ਠੀਕ ਹੈ ਜੀ ਠੀਕ ਹੈ ਸਰ